ਬਲਵਿੰਦਰ ਸਿੰਘ ਜੀ ਸੁਰਜੀਤ ਸਿੰਘ ਅੰਮ੍ਰਿਤਪਾਲ ਸਿੰਘ ਸੰਦੀਪ ਸਿੰਘ ਅਤੇ ਜਗਦੀਪ ਸਿੰਘ ਜੀ ਇਹ ਮੇਰੇ ਯਾਰ ਦੋਸਤ ਪੱਕੇ ਯਾਰ ਦੋਸਤ ਆ ਜੀ ਯਾਰੀ ਐਈਂ ਬਣੀ ਰਵੇ ਇਹਨਾਂ ਨਾਲ ਜੀ ਮੇਰੀ